ਆਮ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਨੇ ਸਾਡੇ ਬਾਈਕਿੰਗ ਨੂੰ ਵੀ ਪ੍ਰਭਾਵਿਤ ਕੀਤਾ ਹੈ ਇਸ ਦੇ ਨਾਲ ਪੈਟਰੋਲ ਦੀ ਵਧਦੀ ਕੀਮਤ ਤਾਂ ਹੈ ਕਿਉਂ ਕਰਕੇ ਮਹਿੰਗਾਈ ਬਹੁਤ ਜ਼ਿਆਦਾ ਵੱਧ ਗਈ ਹੈ ਠੀਕ ਹੈ ਬਹੁਤ ਜ਼ਿਆਦਾ ਪੈਟਰੋਲ ਡੀਜ਼ਲ ਦੀ ਵਰਤੋਂ ਹੋਣ ਲੱਗ ਗਈ ਹੈ ਬਾਲਣ ਦੀ ਵਰਤੋਂ ਹੋਣ ਲੱਗ ਗਈ ਹੈ ਤਾਂ ਕਰਕੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੇ ਜਿਹੜੀਆਂ ਉਹ ਵੱਧਦੀਆਂ ਨੇ ਠੀਕ ਹੈ ਜੀ ਬਾਕੀ ਬਾਲਣ ਬਹੁਤ ਜ਼ਿਆਦਾ ਵਰਤਿਆ ਜਾ ਰਿਹਾ ਹੈ ਅੱਜ ਕੱਲ੍ਹ ਦੇ ਇਨਸਾਨ ਨੇ ਬਾਲਣ ਨੂੰ ਬਹੁਤ ਜ਼ਿਆਦਾ ਵਰਤਣ ਦੇ ਨਾਲ ਵਾਤਾਵਰਨ ਤਾਂ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ ਹੈ ਜਿਸ ਦੇ ਕਾਰਨ ਉਸ ਨੂੰ ਇਹ ਸਾਹਮਣੇ ਉਹਦੇ ਬਹੁਤ ਜ਼ਿਆਦਾ ਦਿੱਕਤਾਂ ਦਾ ਉਹਨੂੰ ਸਾਹਮਣਾ ਕਰਨਾ ਪਵੇਗਾ ਵਾਤਾਵਰਨ ਨੂੰ ਖੁਸ਼ਹਾਲ ਰੱਖਿਆ ਜਾਵੇ ਇਸ ਦੇ ਲਈ ਕੋਈ ਵੀ ਕਦਮ ਨਹੀਂ ਚ ਪੁੱਟ ਰਿਹਾ ਇਸ ਦੇ ਲਈ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾ ਰਿਹਾ ਜੇ ਬਣਾਇਆ ਜਾ ਰਿਹਾ ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਹੈ